ਅਸੀਂ ਵੱਖ ਵੱਖ ਥਾਵਾਂ 'ਤੇ ਕਈ ਤਰ੍ਹਾਂ ਦੀਆਂ ਧਾਰਮਿਕ ਯਾਤਰਾਵਾਂ ਕੀਤੀਆਂ ਹਨ ਜਿੱਥੇ ਕਿ ਇਹ ਤਸਵੀਰਾਂ ਆਮ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਅਸੀਂ ਪਹਿਲੀ ਯਾਤਰਾ ਲਗਭਗ ਦੋ ਹਜ਼ਾਰ ਗਿਆਰਾਂ ਤੋਂ ਸ਼ੁਰੂ ਕੀਤੀ ਸੀ ਜੋ ਕਿ ਨੈਣਾ ਦੇਵੀ ਮਾਤਾ ਕੌਲਾਂ ਮਾਤਾ ਵਿਸ਼ਨੂੰ ਦੇਵੀ ਬਾਲਕ ਨਾਥ ਵਗੈਰਾ ਪਹਿਲੀ ਯਾਤਰਾ ਅਸੀਂ ਗਏ ਸੀ ਉਥੋਂ ਵੱਖ ਵੱਖ ਤਰ੍ਹਾਂ ਦੇ ਧਾਰਮਿਕ ਮਾਤਾਵਾਂ ਦੀਆਂ ਫੋਟੋਆਂ ਤਸਵੀਰਾਂ ਖਰੀਦੀਆਂ ਸੀ ਅਤੇ ਉਸ ਤੋਂ ਬਾਅਦ ਅਸੀਂ ਲਗਭਗ ਕਈ ਧਰਮਿਕ ਸਥਾਨਾਂ 'ਤੇ ਜਿਵੇਂ ਹਜ਼ੂਰ ਸਾਹਿਬ ਧਰਮਿਕ ਸਥਾਨ ਆ ਗਿਆ ਉਸ ਤੋਂ ਬਾਅਦ ਸ੍ਰੀ ਹੇਮਕੁੰਟ ਸਾਹਿਬ ਧਰਮਿਕ ਸਥਾਨ ਆ ਗਿਆ ਉੱਥੋਂ ਵੀ ਕਈ ਤਰ੍ਹਾਂ ਦੀਆਂ ਵੱਖ ਵੱਖ ਤਸਵੀਰਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਾਂ ਹਜ਼ੂਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਗੈਰਾ ਦੀਆਂ ਫੋਟੋਆਂ ਤਸਵੀਰਾਂ ਬਹੁਤ ਖਰੀਦੀਆਂ ਸਨ ਅਤੇ ਉਸ ਤੋਂ ਬਾਅਦ ਅਸੀਂ ਇਹ ਧਾਰਮਿਕ ਸਥਾਨ ਤਾਂ ਰਾਧਾ ਸੁਆਮੀ ਸ਼੍ਰੀ ਬਿਆਸ ਬਿਆਸ ਸਾਹਿਬ ਗਏ ਸੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਯਾਤਰਾਵਾਂ ਕੀਤੀਆਂ ਹਨ ਧਾਰਮਿਕ ਸਥਾਨ ਆ ਗਏ ਮਨੀਕਰਨ ਵਗੈਰਾ ਮਨਾਲੀ ਹੋਰ ਵੀ ਵੱਖ ਵੱਖ ਤਰ੍ਹਾਂ ਦੇ ਧਾਰਮਿਕ ਸਥਾਨ ਸਨ ਜਿੱਥੋਂ ਅਸੀਂ ਕਈ ਤਰ੍ਹਾਂ ਦੀਆਂ ਭਾਰਤ ਦੇ ਕਈ ਤਰ੍ਹਾਂ ਦੇ ਅਜਿਹੇ ਧਾਰਮਿਕ ਪ੍ਰੋਗਰਾਮ ਹਨ ਜਿੱਥੋਂ ਅਸੀਂ ਇਹ ਤਸਵੀਰਾਂ ਖਰੀਦੀਆਂ ਅਤੇ ਫੋਟੋਆਂ ਲਈਆਂ ਸ਼੍ਰੀ ਗੁਰੂ ਨਾਨਕ ਦੇਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼੍ਰੀ ਗੁਰੂ ਅਰਜਨ ਦੇਵ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬੰਦਾ ਸਿੰਘ ਬਹਾਦਰ ਜਾਂ ਹੋਰ ਕਹਿ ਲਓ ਬਾਬਾ ਦੀਪ ਸਿੰਘ ਵਗੈਰਾ ਦੀਆਂ ਫੋਟੋਆਂ ਵੀ ਬਹੁਤ ਜ਼ਿਆਦਾ ਖਰੀਦੀਆਂ ਸਨ ਜੋ ਕਿ ਅੱਜ ਕੱਲ੍ਹ ਸਾਨੂੰ ਇਹ ਤਸਵੀਰਾਂ ਆਮ ਇੰਟਰਨੈਟ ਵਗੈਰਾ ਤੋਂ ਵੀ ਮਿਲ ਸਕਦੀਆਂ ਹਨ ਪਰ ਦੋ ਹਜ਼ਾਰ ਗਿਆਰਾਂ ਵਿੱਚ ਇਹ ਤਸਵੀਰਾਂ ਆਮ ਤੌਰ 'ਤੇ ਹੱਥਾਂ ਨਾਲ ਬਣਾਈਆਂ ਜਾਂਦੀਆਂ ਸਨ ਜੋ ਕਿ ਵੱਡੇ ਵੱਡੇ ਕੈਲੰਡਰਾਂ ਦੇ ਰੂਪ ਵਿੱਚ ਤਿਆਰ ਹੋਈਆਂ ਹਵਾਈਆਂ ਸਾਨੂੰ ਮਿਲ ਜਾਂਦੀਆਂ ਸਨ ਅਸੀਂ ਸ਼੍ਰੀ ਗੁਰੂ ਅੰਬਰਸਰ ਸਾਹਿਬ ਵਿਖੇ ਕਈ ਵਾਰ ਵੀ ਗਏ ਹਾਂ ਜਿੱਥੋਂ ਕਿ ਗੋਲਡ ਟੈਂਪਲ ਅੰਗਰੇਜ਼ੀ ਵਿੱਚ ਬੋਲਿਆ ਜਾਂਦਾ ਗੋਲਡ ਟੈਂਪਰ ਨੂੰ ਦੀਆਂ ਤਸਵੀਰਾਂ ਵੀ ਅਸੀਂ ਬਹੁਤ ਵਾਰ ਲੈ ਕੇ ਖਰੀਦੀਆਂ ਹਨ ਅਤੇ ਜੋ ਫੋਟੋਆਂ ਸਾਨੂੰ ਇੱਕ ਦਿਲਚਸਪ ਖਿੱਚਣ ਦਿਲ ਖਿੱਚਣ ਵਾਲੀਆਂ ਤਸਵੀਰਾਂ ਹੁੰਦੀਆਂ ਸਨ ਅਤੇ ਵੱਖ ਵੱਖ ਤਰ੍ਹਾਂ ਦੇ ਧਾਰਮਿਕ ਸਥਾਨ ਲਾ ਲਓ ਜਿੱਥੇ ਜਾਣਾ ਜ਼ਰੂਰੀ ਹੁੰਦਾ ਜਿੱਥੇ ਜਾ ਕੇ ਧਾਰਮਿਕ ਸਥਾਨਾਂ 'ਤੇ ਸ਼ਾਂਤੀ ਮਹਿਸੂਸ ਹੁੰਦੀ ਹੈ ਸ਼੍ਰੀ ਹੇਮਕੁੰਟ ਸਾਹਿਬ ਗਏ ਤਾਂ ਬਹੁਤ ਹੀ ਪਹਾੜੀਆਂ ਵਿੱਚ ਆਨੰਦ ਮਾਨਣ ਨੂੰ ਮਿਲਦਾ ਸ਼੍ਰੀ ਗੁਰੂ ਸ਼੍ਰੀ ਹਜ਼ੂਰ ਸਾਹਿਬ ਗਏ ਉੱਥੇ ਬਹੁਤ ਜ਼ਿਆਦਾ ਉਹ ਹੁੰਦਾ ਹੈਗਾ ਹਰਿਦੁਆਰ ਵਗੈਰਾ ਗਏ ਮਸਤੂਆਣਾ ਸਾਹਿਬ ਹੋਰ ਵੀ ਵੱਖ ਵੱਖ ਤਰ੍ਹਾਂ ਦੇ ਧਾਰਮਿਕ ਸਥਾਨ ਹਨ ਜਿੱਥੋਂ ਅਲੱਗ ਅਲੱਗ ਤਰ੍ਹਾਂ ਦੀਆਂ ਦਿਲ ਖਿੱਚਵੀਆਂ ਤਸਵੀਰਾਂ ਸਾਨੂੰ ਮਿਲਦੀਆਂ ਹਨ ਅਤੇ ਇਹ ਤਸਵੀਰਾਂ ਅੱਜ ਵੀ ਸਾਡੇ ਘਰ ਵਿਖੇ ਮੌਜੂਦ ਹਨ ਜਿਹਨਾਂ ਨੂੰ ਕਿ ਅਸੀਂ ਰੱਬ ਵਾਂਗ ਪੂਜਦੇ ਹਾਂ ਇਸ ਮੌਕੇ ਸਾਨੂੰ ਤਸਵੀਰਾਂ ਦੀ ਸਾਂਭ ਸੰਭਾਲ ਵੀ ਕਰਨੀ ਜ਼ਰੂਰੀ ਹੈ ਲਗਭਗ ਇਹਨਾਂ ਨੂੰ ਅਸੀਂ ਫਰੇਮ ਵਗੈਰਾ ਕਰਵਾ ਕੇ ਇਹ ਤਸਵੀਰਾਂ ਨੂੰ ਇੱਕ ਸ਼ੋ ਪੀਸ ਵਿੱਚ ਲਗਾਈਆਂ ਗਈਆਂ ਸਨ ਅਤੇ ਇਹ ਤਸਵੀਰਾਂ 'ਤੇ ਅਸੀਂ ਇਹੀ ਕੁਝ ਕਹਿਣਾ ਚਾਹੁੰਦੇ ਹਾਂ ਧੰਨਵਾਦ